ਜੀ ਜੀ ਅੱਛਾ ਕਿਹੜੀ ਕੰਪਨੀ ਤੋਂ ਖਰੀਦਿਆ ਤੁਸੀਂ ਸੈਮਸੰਗ ਠੀਕ ਹੈ ਸੈਮਸੰਘ ਕਟਸਮਰ ਕੇਅਰ ਤੋਂ ਜੀ ਤੁਸੀਂ ਗੱਲ ਕਰ ਰਹੇ ਹੋ ਸੈਮਸਮ ਸੈਮਸੰਗ ਕਸਟਮਰ ਕੇਅਰ ਤੋਂ ਜੀ ਤੁਸੀਂ ਗੱਲ ਕਰ ਰਹੇ ਹੋ ਦੱਸੋ ਕਿ ਦਿੱਕਤ ਆਈ ਹੈ ਜੀ ਤੁਸੀਂ ਉਹਦਾ ਇੱਕ ਮੈਨੂੰ ਬਿੱਲ ਦੀ ਕਾਪੀ ਭੇਜ ਸਕਦੇ ਹਾਂ ਇੱਕ ਤਾਂ ਤੁਸੀਂ ਮੈਨੂੰ ਉਹਦੇ ਬਿਲ ਦੀ ਕਾਪੀ ਭੇਜਣੀ ਹੈਗੀ ਹੈ ਇੱਕ ਤੁਹਾਡਾ ਵਾਰੰਟੀ ਕਾਰਡ ਹੋਵੇਗਾ ਉਸ ਵਾਰੰਟੀ ਕਾਰਡ ਦੀ ਤੁਸੀਂ ਫੋਟੋ ਭੇਜੋਗੇ ਮੈਨੂੰ ਕਰ ਦੇਣਾ ਇਸੇ ਨੰਬਰ ਪਰ ਅਤੇ ਉਸ ਦੇ ਨਾਲ ਹੀ ਤੁਹਾਡਾ ਐਡਰੈਸ ਕੀ ਹੈ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਪ੍ਰੋਪਰਲੀ ਡਰੈਸ ਦੱਸੋ ਵਿਜੇ ਕਲੋਨੀ ਫਾਜ਼ਿਲਕਾ ਪ੍ਰੋਪਰ ਡਰੈਸ ਦਿਓ ਓਕੇ ਠੀਕ ਠੀਕ ਠੀਕ ਅਤੇ ਡਿਸਟਿਕ ਡਿਸਟ੍ਰਿਕ ਤੁਹਾਨੂੰ ਕਿਹੜਾ ਲੱਗਦਾ ਫਾਜ਼ਿਲਕਾ ਜੀ ਤਹਿਸੀਲ ਕਿਹੜੀ ਲੱਗਦੀ ਹੈ ਲੋਕਲ ਲੋਕਲ ਠੀਕ ਹੈ ਜੀ ਠੀਕ ਹੈ ਤਾਂ ਜੇ ਜਿਹੜੀ ਵੀ ਦਿੱਕਤ ਹੈਗੀ ਤੁਹਾਡੀ ਤੁਸੀਂ ਇੱਕ ਤਾਂ ਮੈਨੂੰ ਜਿਹੜੀਆਂ ਤੁਹਾਨੂੰ ਚੀਜ਼ਾਂ ਕਹੀਆਂ ਗਈਆਂ ਉਹ ਭੇਜ ਦੇਣਾ ਫੋਟੋ ਕਰਕੇ ਇੱਕ ਤੁਸੀਂ ਉਹਨਾਂ ਦੀ ਫੋਟੋ ਕਾਪੀ ਜਿਹੜੀ ਕਰਵਾ ਕੇ ਰੱਖਣੀ ਹੈ ਬਿੱਲ ਦੀ ਅਤੇ ਵਾਰੰਟੀ ਕਾਰਡ ਦੀ ਤਾਂਕਿ ਜਦੋਂ ਵੀ ਮਕੈਨਿਕ ਆਵੇਗਾ ਜਾਂ ਤਾਂ ਤੁਹਾਡੇ ਕੋਲ ਇਹ ਚੀਜ਼ਾਂ ਜਿਹੜੀਆਂ ਉਹ ਰਿਸੀਵ ਕਰੂਗਾ ਕਿਉਂਕਿ ਉਸਨੇ ਰਿਸੀਵ ਕਰਨ ਤੋਂ ਬਾਅਦ ਹੀ ਤੁਹਾਡੀ ਜਿਹੜੀ ਇਹਦੀ ਰਿਪੇਅਰ ਕਰਨੀ ਹੈ ਇਹ ਵਾਰੰਟੀ ਕਿੰਨਾ ਕੁ ਹਾਂਜੀ ਓਕੇ ਇਨਵਾਈਸ ਇਨਵਾਇਸ ਕਰ ਰਹੇ ਆ ਠੀਕ ਠੀਕ ਚਲੋ ਉਹ ਤਾਂ ਮਕੈਨਿਕ ਆਵੇਗਾ ਤਾਂ ਜੇ ਤੁਹਾਡਾ ਉਹਦੇ ਵਿੱਚ ਮੋਟਰ ਚੇਂਜ ਕਰਨ ਵਾਲੀ ਹੋਈ ਤਾਂ ਮੋਟਰ ਚੇਂਜ ਕੀਤੀ ਜਾਊਗੀ ਰੀਪਲੇਸ ਹੋ ਜਾਵੇਗੀ ਉਹ ਤਾਂ ਦੇਖਣ 'ਤੇ ਪਤਾ ਚੱਲੇਗਾ ਹਾਂ ਹਾਂ ਵਰੰਟੀ ਹੋਵੇਗੀ ਉਹਦੀ ਫਾਈਵ ਈਅਰ ਹੋਵੇਗੀ ਕੰਪਲੀਟਲੀ ਹੋਵੇਗੀ ਠੀਕ ਠੀਕ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਤੁਹਾਡਾ ਜਿਹੜਾ ਜਲਦੀ ਤੋਂ ਜਲਦੀ ਸਲੂਸ਼ਨ ਕਰਵਾ ਦਿੱਤਾ ਜਾਵੇਗਾ ਬਸ ਜਿਹੜੀਆਂ ਚੀਜ਼ਾਂ ਸਾਨੂੰ ਕਿਹਾ ਹੈਗਾ ਇਹ ਚੀਜ਼ਾਂ ਤੁਸੀਂ ਪ੍ਰੋਪਰਲੀ ਰੈਡੀ ਕਰਕੇ ਰੱਖਣੀਆਂ ਬਸ ਤੁਹਾਡੇ ਕੋਲੇ ਇੱਕ ਜਾਂ ਦੋ ਦਿਨ ਵਿੱਚ ਕੱਲ ਜਾਂ ਪਰਸੋਂ ਤੁਹਾਡੇ ਕੋਲੇ ਪਹੁੰਚ ਜਾਏਗਾ ਬਸ ਤੁਹਾਡਾ ਨੰਬਰ ਇਹੀ ਚਲਦਾ ਨਾ ਬਸ ਤੁਹਾਨੂੰ ਕਾਲ ਆਵੇਗੀ ਉਸ ਤੋਂ ਪਹਿਲਾਂ ਹਾਂ ਬਸ ਸ਼ਾਇਦ ਕੱਲ ਹੀ ਆ ਜਾਵੇਗਾ ਤੁਸੀਂ ਬਸ ਫੋਨ ਜਿਹੜਾ ਪਿੱਕ ਕਰ ਲੈਣਾ ਠੀਕ ਹੈ ਜੀ ਨਾ ਨਾ ਨਾ ਬਸ ਓਕੇ ਹੋ ਜਾਏਗਾ ਤੁਹਾਡਾ ਜਲਦੀ ਚਲੋ ਠੀਕ ਹਾਂ ਠੀਕ ਹੈ ਜੀ ਠੀਕ ਹੈ ਓਕੇ